ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਸਰ ਵੇਟ ਮੈ ਦੱਸਦੀ ਹਾਂ ਹਾਂਜੀ ਰੋਮਨ ਦੇ ਨਾ ਰੋਮਨ ਦੇ ਇੰਗਲਿਸ਼ 'ਚ ਮਾਰਕਸ ਆਏ ਫਿਫਟੀ ਏਟ ਔਰ ਸਾਇੰਸ 'ਚ ਉਹਦੇ ਸਿਕਸਟੀ ਨਾਈਨ ਪੰਜਾਬੀ 'ਚ ਸੈਵਨਟੀ ਏਟ ਹਾਂਜੀ ਔਰ ਉਹਦੇ ਈ ਵੀ ਐਸ 'ਚ ਥੋੜ੍ਹੇ ਜਿਹੇ ਮਾਕਸ ਘੱਟ ਆਏ ਨੇ ਹਾਂਜੀ ਅਤੇ ਉਹਦੇ ਵਿੱਚ ਉਹਦੀ ਥੋੜ੍ਹੀ ਜਿਹੀ ਹੈਲਪ ਕਰਿਓ ਮਤਲਬ ਬੜੇ ਈਜ਼ੀ ਆ ਸਬਜੈਕਟ ਬਾਕੀ ਠੀਕ ਆ ਪੜ੍ਹਨ 'ਚ ਬਟ ਕਲਾਸ 'ਚ ਇਹ ਸ਼ਰਾਰਤਾਂ ਬਹੁਤ ਕਰਦਾ

ਹਾਂਜੀ ਹਾਂਜੀ ਉਹ ਕੋਈ ਨਾ ਅਸੀਂ ਮਦਦ ਤਾਂ ਕਰਾਂਗੇ ਪੇਰੈਂਟਸ ਦਾ ਵੀ ਬਣਦਾ ਵਾ ਔਰ ਤੁਸੀਂ ਵੀ ਇੱਕ ਵਾਰ ਉਹਦੇ ਵੱਲ ਧਿਆਨ ਦਿਓ ਹਾਂਜੀ ਵੈਸੇ ਜ਼ਰੂਰੀ ਨਹੀਂ ਹੈ ਕਿ ਹਰ ਟਾਈਮ ਪੜ੍ਹਨਾ ਹੀ ਚਾਹੁੰਦੇ ਆ ਮਤਲਬ ਪੜ੍ਹਨਾ ਹੀ ਹੁੰਦਾ ਵਾ ਉਸ ਨੂੰ ਪਾਰਟੀਸਪੇਟ ਵੀ ਕਰਨਾ ਚਾਹੀਦਾ ਭੰਗੜਾ ਹੋ ਗਿਆ ਕੋਈ ਹੋਰ ਵੀ ਸਕਿੱਲਸ ਹੋ ਗਈ ਪਾਰਟੀਸਪੇਟ ਕਰ ਸਕਦਾ ਵਾ ਤੁਸੀਂ ਇੱਕ ਵਾਰ ਉਹ ਨੂੰ ਸਮਝਾ ਦਿਓ ਔਰ ਪੜ੍ਹਾਈ ਵੱਲ ਵੀ ਧਿਆਨ ਦੇ ਔਰ ਇੱਦਾਂ ਦੀ ਸਕਿੱਲਸ ਵੱਲ ਵੀ ਧਿਆਨ ਦੇ ਹਾਂਜੀ ਹਾਂਜੀ ਓਕੇ ਇਟਸ ਓਕੇ ਸਤਿ ਸ਼੍ਰੀ ਅਕਾਲ